ਹਾਂਜੀ ਮੈਂ ਜਿੱਥੇ ਰਹਿੰਦਾ ਹਾਂ ਮੈਨੂੰ ਉੱਥੇ ਬਹੁਤ ਸਾਰੀਆਂ ਬੁਨਿਆਦੀ ਢਾਂਚਾ ਉੱਥੇ ਖਰਾਬ ਹੈ ਅਤੇ ਆਵਾਜਾਈ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਮੈਨੂੰ ਕਰਨਾ ਪੈਂਦਾ ਹੈ ਜੇਕਰ ਮੈਂ ਬੁਨਿਆਦੀ ਢਾਂਚੇ ਬਾਰੇ ਗੱਲ ਕਰਾਂ ਤਾਂ ਉੱਥੇ ਬੱਸ ਸਟੈਂਡ ਦੇ ਉੱਤੇ ਸਾਫ਼ ਸੁਥਰੀ ਲੋਕਾਂ ਵਾਸਤੇ ਬੈਠਣ ਲਈ ਥਾਂ ਨਹੀਂ ਹੈ ਜੇ ਮੀਂਹ ਦਾ ਸ ਸਮਾਂ ਹੁੰਦਾ ਹੈ ਤਾਂ ਉਸ ਮੀਂਹ ਦੇ ਸਮੇਂ ਸਵਾਰੀਆਂ ਨੂੰ ਲੁਕਣ ਵਾਸਤੇ ਕੋਈ ਵੀ ਥਾਂ ਮੌਜੂਦ ਨਹੀਂ ਹੈ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਰਕਾਰ ਉੱਥੇ ਸ਼ੈੱਡ ਜਾਂ ਕੋਈ ਤਰਪਾਲ ਵਗੈਰਾ ਦਾ ਸਿਸਟਮ ਅਰੇਜਮੈਂਟ ਕਰ ਸਕੇ ਅਤੇ ਹੋਰ ਆਵਾਜਾਈ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਵੇਂ ਕਿ ਬੱਸਾਂ ਦੇ ਵਿੱਚ ਖਰਾਬ ਸੀਟਾਂ ਹੁੰਦੀਆਂ ਹਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਨਵੀਂ ਸੀਟਾਂ ਵਾਲੀਆਂ ਬੱਸਾਂ ਸਰਕਾਰ ਲੋਕਾਂ ਵਾਸਤੇ ਜਿਹੜਾ ਹੈਗਾ ਉਪਲਬਧ ਕਰਵਾਈ ਜਾਣ ਅਤੇ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਲੋਕਲ ਪੀਪਲ ਨੂੰ ਦੇ ਕੇ ਦੇਣੀਆਂ ਚਾਹੀਦੀਆਂ ਹਨ ਅਤੇ ਹੋਰ ਸਾਰੀਆਂ ਚੁਣੋਤੀਆਂ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਖਰਾਬ ਰੋਡ ਹੁਣ ਸੜਕਾਂ ਦੇ ਵਿੱਚ ਗੱਡੇ ਹੁੰਦੇ ਹਨ ਅਤੇ ਸਰਕਾਰ ਨੂੰ ਇਹ ਨਵੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ